ਹਾਂਜੀ ਮੈਨੂੰ ਟੀ ਵੀ ਚੈਨਲ 'ਤੇ ਸੰਜੀਵ ਕਪੂਰ ਦਾ ਜਿਹੜਾ ਪ੍ਰੋਗਰਾਮ ਹੈ ਖਾਣਾ ਖਜ਼ਾਨਾ ਉਹ ਬਹੁਤ ਪਸੰਦ ਹੈ ਔਰ ਪਸੰਦ ਇਸ ਕਰਕੇ ਹੈ ਕਿ ਉਹ ਬੜੀ ਜਿਹੜੀ ਹੁੰਦੀ ਆ ਔਖੀ ਵੀ ਕੋਈ ਹੋਊਗੀ ਤੁਹਾਡੇ ਲਈ ਕੋਈ ਡਿਸ਼ ਤਿਆਰ ਕਰਨੀ ਅਤੇ ਉਹ ਬੜੇ ਸੌਖੇ ਤਰੀਕੇ ਨਾਲ ਸੌਖੇ ਢੰਗ ਨਾਲ ਜਿਹੜੇ ਉਹ ਆਪਾਂ ਨੂੰ ਸਮਝਾ ਜਾਂਦੇ ਨੇ ਜਿਵੇਂ ਮੇਰਾ ਕੁਕੀ 'ਚ ਕੋਈ ਖਾਸ ਵਧੀਆ ਹੱਥ ਨਹੀਂ ਸੀਗਾ ਪਹਿਲੇ ਮੈਨੂੰ ਥੋੜ੍ਹਾ ਜਿਹਾ ਹੁੰਦਾ ਸੀਗਾ ਕੂਕਿੰਗ ਦਾ ਬਟ ਜਦੋਂ ਮੈਂ ਪ੍ਰੋਗਰਾਮ ਦੇਖਿਆ ਤਾਂ ਮੈਂ ਦੇਖੀਆਂ ਛੋਟੀਆਂ ਛੋਟੀਆਂ ਚੀਜ਼ਾਂ ਉਹ ਕਿੰਨੇ ਤਰੀਕੇ ਨਾਲ ਬਣਾਉਂਦੇ ਸੀਗੇ ਅਤੇ ਮੈਂ ਹੌਲੀ ਹੌਲੀ ਆਪਣੇ ਘਰ ਦੇ ਵਿੱਚ ਉਹ ਬਣਾਉਣੀਆਂ ਸ਼ੁਰੂ ਕੀਤੀਆਂ ਪਹਿਲਾਂ ਤਾਂ ਮੈਨੂੰ ਥੋੜ੍ਹਾ ਔਖਾ ਲੱਗਾ ਬਟ ਜਦੋਂ ਮੈਂ ਰੋਜ਼ਾਨਾ ਉਹਨਾਂ ਦਾ ਪ੍ਰੋਗਰਾਮ ਹੀ ਦੇਖਦੀ ਸੀ ਉਹਨਾਂ ਦੇ ਸਮਝਾਉਣ ਦਾ ਤਰੀਕਾ ਮੈਨੂੰ ਵਧੀਆ ਲੱਗਾ ਵੀ ਅੱਛੀ ਤਰ੍ਹਾਂ ਸਮਝ ਆ ਗਿਆ ਅਤੇ ਮੈਂ ਘਰ ਦੇ ਵਿੱਚ ਉਹ ਚੀਜ਼ਾਂ ਬਣਾਉਣੀਆਂ ਸ਼ੁਰੂ ਕੀਤੀਆਂ ਉਹ ਤਾਂ ਇੱਥੋਂ ਤੱਕ ਕਿ ਜਿਵੇਂ ਆਪਾਂ ਕੱਲ੍ਹ ਦੀ ਸਬਜ਼ੀ ਹੈ ਜਾਂ ਕੋਈ ਚਾਵਲ ਨੇ ਜਾਂ ਕੋਈ ਵੀ ਮਟੀਰੀਅਲ ਇਹੋ ਜਿਹਾ ਹੈ ਜਿਹੜਾ ਆਪਾਂ ਅਗਲੇ ਦਿਨ ਨਹੀਂ ਖਾਣਾ ਉਸ ਨੂੰ ਵੀ ਬੜੇ ਤਰੀਕੇ ਨਾਲ ਸਜਾ ਕੇ ਇੰਨਾ ਸੋਹਣਾ ਬਣਾ ਦਿੰਦੇ ਸੀਗੇ ਸਾਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਇਹ ਉਹ ਡਿਸ਼ ਹੈ ਕਿ ਅਸੀਂ ਕੋਈ ਨਵੀਂ ਡਿਸ਼ ਤਿਆਰ ਕੀਤੀ ਹੈ ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਬੱਚੇ ਜਿਹੜੇ ਆ ਉਹ ਜ਼ਿਆਦਾਤਰ ਹਰੀਆਂ ਸਬਜ਼ੀਆਂ ਤੋਂ ਜਾਂ ਇਸ ਤਰ੍ਹਾਂ ਥੋੜ੍ਹਾ ਜਿਹਾ ਰੋਟੀ ਤੋਂ ਕਰਦੇ ਨੇ ਪਰ ਉਹਨਾਂ ਦੀਆਂ ਕੁਛ ਡਿਸ਼ ਨੇ ਜਿਹੜੀਆਂ ਮੈਂ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਬਣਾ ਕੇ ਵੇਖਿਆ ਅਤੇ ਮੇਰੇ ਬੱਚੇ ਨੇ ਵੀ ਬੜੇ ਖੁਸ਼ ਹੋ ਕੇ ਖਾਧੀਆਂ ਸੋ ਉਹਨਾਂ ਦਾ ਤਰੀਕਾ ਬੜਾ ਆ ਸਮਝਾਉਣ ਦਾ ਬਹੁਤ ਵਧੀਆ ਆ ਅਤੇ ਮੈਂ ਉਹਨਾਂ ਤੋਂ ਕਈ ਤਰ੍ਹਾਂ ਦੀਆਂ ਰੈਸਪੀ ਜਿਹੜੀਆਂ ਉਹ ਬਣਾਉਣੀਆਂ ਸਿੱਖੀਆਂ ਅਤੇ ਸੋ ਇਸ ਲਈ ਮੈਂ ਚੈਨਲ ਦਾ ਜਿਹੜਾ ਹੈ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਥੈਂਕ ਯੂ